ਖੇਡਾਂ ਖੇਡਣ ਵਾਲਾ ਖਿਡਾਰੀ ਸਟ੍ਰੈੱਸ ਰਹਿਤ ਰਹਿੰਦਾ ਹੈ ਕਿਉਂਕਿ ਉਹ ਸਵੇਰੇ ਸੱਜਰੇ ਤਾਜ਼ੀ ਹਵਾ ਲੈਂਦਾ ਹੈ ਸੈਰ ਕਰਕੇ ਆਉਂਦਾ ਹੈ ਅਤੇ ਆਪਣੀ ਕਸਰਤ ਕਰਦਾ ਹੈ ਕਸਰਤ ਕਰਨ ਤੋਂ ਬਾਅਦ ਉਹ ਘਰ ਆਉਂਦਾ ਹੈ ਅਤੇ ਆਪਣੀ ਜੋ ਵੀ ਉਹਦੀ ਖੁਰਾਕ ਹੁੰਦੀ ਹੈ ਵੋ ਲੈਂਦਾ ਹੈ ਉਹ ਲੈਣ ਤੋਂ ਬਾਅਦ ਉਹ ਆਪਣੇ ਗਰਾਊਂਡ ਜਾਂਦਾ ਹੈ ਅਤੇ ਖੇਡ ਖੇਡਦਾ ਹੈ ਅਤੇ ਬਾਹਰ ਮਿਲਦਾ ਹੈ ਕਿਉਂਕਿ ਘਰ ਰਹਿਣ ਵਾਲਾ ਵਿਅਕਤੀ ਹਮੇਸ਼ਾਂ ਹੀ ਚਿੜਚਿੜਾ ਰਹਿੰਦਾ ਹੈ ਇਸ ਲਈ ਖਿਡਾਰੀ ਕਦੇ ਵੀ ਕਿਸੇ ਨਾਲ ਬੇਫਾਲਤੂ ਨਹੀਂ ਬੋਲਦੇ ਅਤੇ ਉਹ ਹਮੇਸ਼ਾਂ ਹੀ ਤੰਦਰੁਸਤ ਰਹਿੰਦੇ ਹਨ ਅਤੇ ਹਰੇਕ ਨਾਲ ਹੱਸ ਕੇ ਮਿਲਦੇ ਹਨ ਅਤੇ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਅਤੇ ਉਹ ਹਮੇਸ਼ਾਂ ਦੂਜਿਆਂ ਦੀ ਦੀ ਸਤਿਕਾਰ ਕਰਦਾ ਹੈ